ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ

ਹਾਂਜੀ ਮੈਮ ਯੈੱਸ ਹਾਂਜੀ ਮੈਮ ਮੈਂ ਇਹਦੇ ਪਾਪਾ ਨੂੰ ਜਾਂ ਬ੍ਰਦਰ ਦੀ ਏ ਵੇਟ ਕਰਦੀ ਹਾਂ ਉਹ ਆ ਜਾਂਦੇ ਤਾਂ ਲੈ ਜਾਂਦੇ ਆ ਜ਼ਿਆਦਾ ਤਾਂ ਨਹੀਂ ਹੈ ਬੁਖਾਰ ਮਤਲਬ ਠੀਕ ਹੈ ਨਾ ਓਕੇ ਮੈਮ ਕੋਈ ਬਾਤ ਨਹੀਂ ਮੈਂ ਭੇਜ ਦਿੰਦੀ ਏ ਕਿਸੇ ਨੂੰ ਔਰ ਤੁਸੀਂ ਇਸ ਤਰ੍ਹਾਂ ਕਰੋ ਇਹਨੂੰ ਦਵਾਈ ਦੇ ਕੇ ਓਨੀ ਦੇਰ ਰੈਸਟ ਰੈਸਟ ਰੂਮ 'ਚ ਪਾ ਦਿਉ ਫਿਰ ਮੈਂ ਉਹਦੇ ਪਾਪਾ ਆਉਂਦੇ ਹੈ ਨਾ ਗਏ ਹੋਏ ਆ ਜੇ ਕੰਮ 'ਤੇ ਤਾਂ ਫਿਰ ਉਹਨਾਂ ਨੂੰ ਭੇਜ ਦਿੰਦੀ ਹਾਂ ਲੈਣ ਵਾਸਤੇ ਓਕੇ ਮੈਮ ਵੈਸੇ ਤਾਂ ਡਾਇਰੀ ਵਿੱਚ ਲਿਖਿਆ ਹੋਇਆ ਪਾਪਾ ਦਾ ਫੋਨ ਨੰਬਰ ਔਰ ਪਾਪਾ ਦੀ ਫੋਟੋ ਵੀ ਹੈ ਔਰ ਬ੍ਰਦਰ ਦੀ ਵੀ ਹੈ ਉੱਥੇ ਪੂਰੀ ਡਿਟੇਲ ਹੈ ਉਹਨਾਂ ਦੀ ਬਾਕੀ ਜੇ ਜਦੋਂ ਪਹੁੰਚਣਗੇ ਤੁਸੀਂ ਮੈਨੂੰ ਕਾਲਿੰਗ ਕਰ ਲਿਓ ਮੈਂ ਤੁਹਾਨੂੰ ਦੱਸ ਦੂਗੀ ਜਾਂ ਜਦੋਂ ਘਰੋਂ ਚੱਲਣਗੇ ਤਾਂ ਮੈਂ ਕਾਲ ਕਰ ਦੂਗੀ ਤੁਹਾਨੂੰ ਠੀਕ ਹੈ ਮੈਮ ਕੋਈ ਬਾਤ ਨਹੀਂ ਥੋੜ੍ਹੀ ਦੇਰ ਤੱਕ ਆ ਜਾਂਦੇ ਓਕੇ ਮੈਮ ਥੈਂਕ ਯੂ ਓਕੇ ਮੈਮ ਥੈਂਕ ਯੂ ਮੈਮ